ਹੈਲੋ ਹਾਂਜੀ ਅਮਨਦੀਪ ਜੀ ਬੋਲਦੇ ਹੋ ਕੰਪਿਊਟਰ ਰਿਪੇਅਰ ਸੈਂਟਰ ਤੋਂ ਬੋਲਦੇ ਹੋ ਸਰ ਹਾਂਜੀ ਮੈਨੂੰ ਤੁਹਾਡਾ ਨੰਬਰ ਮਿਲਿਆ ਸੀਗਾ ਜੀ ਅਤੇ ਮੇਰੇ ਕੋਲੇ ਜੀ ਪੁਰਾਣਾ ਕੰਪਿਊਟਰ ਪਿਆ ਅਤੇ ਉਹਦੀ ਨਾ ਵਿੰਡੋ ਵੀ ਇੱਕ ਤਾਂ ਮਤਲਬ ਛੋਟੀ ਹੈ ਪੁਰਾਣੇ ਵਰਜਨ ਦੀ ਅੱਜ ਕੱਲ੍ਹ ਤਾਂ ਜਿਵੇਂ ਟੈੱਨ ਇਲੈਵਨ ਹੈ ਨਾ ਇੰਨਾ ਹੋ ਗਿਆ ਕੰਮ ਅਤੇ ਕੰਪਿਊਟਰ ਥੋੜ੍ਹਾ ਪੁਰਾਣਾ ਹੀ ਹੈ ਜੀ ਅਤੇ ਉਹਦਾ ਨਾ ਆਪਾਂ ਸਿਸ ਹਾਂਜੀ ਹਾਂਜੀ ਚਾ ਤਿੰਨ ਚਾਰ ਪੰਜ ਸਾਲ ਪੁਰਾਣਾ ਹੈਗਾ ਅਤੇ ਉਹਦੀ ਨਾ ਜਿਵੇਂ ਆਪਾਂ ਨਵੀਆਂ ਚੀਜ਼ਾਂ ਵੀ ਇੰਸਟੋਲੇਸ਼ਨ ਕਰਨੀਆਂ ਉਹਦੇ ਵਿੱਚ ਵਿੰਡੋ ਵਿੰਡੋ ਹੋਏਗੀ ਓਸ ਤੋਂ ਬਾਅਦ ਓ ਚ ਕੋਈ ਇੱਕ ਦੋ ਸੋਫਟਵੇਅਰ ਹੋ ਜਾਣਗੇ ਹੈ ਨਾ ਅਤੇ ਮੈਨੂੰ ਤੁਸੀਂ ਇਹਦੇ ਬਾਰੇ ਬ੍ਰੀਫਲੀ ਦੱਸ ਦਿਓ ਵੀ ਅੱਜ ਕੱਲ੍ਹ ਕੀ ਸਿਸਟਮ ਚੱਲ ਰਿਹਾ

ਹਾਂ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਪੀਡ ਵਗੈਰਾ ਬਣ ਜਾਏਗੀ ਕੰਪਿਊਟਰ ਦੀ ਨਾ ਵਧੀਆ ਥੋੜ੍ਹਾ ਜਿਹਾ ਸਪੀਡ ਘਟੀ ਪਈ ਉਹਦੀ ਹਾਂਜੀ ਸਪੇਸ ਹਾਂਜੀ ਸਪੇਸ ਜਿਵੇਂ ਹੁਣ ਨਾ ਜ਼ਿਆਦਾ ਕੈਸ਼ ਡਾਟਾ ਵਗੈਰਾ ਹੋਇਆ ਪਿਆ ਅਤੇ ਹਾਂ ਚਲੋ ਹਾਂਜੀ ਅਤੇ ਠੀਕ ਹੈ ਮੈਨੂੰ ਮੈਨੂੰ ਮੇਰੇ ਦੋਸਤ ਨੇ ਤੁਹਾਡਾ ਨੰਬਰ ਦਿੱਤਾ ਸੀ ਅਤੇ ਉਹ ਕਹਿੰਦੇ ਸਰ ਨਾਲ ਗੱਲ ਕਰ ਲਿਓ ਤੁਹਾਡਾ ਉਹ ਕੰਪਿਊਟਰ ਬਹੁਤ ਵਧੀਆ ਬਣਾ ਦੇਣਗੇ ਅਤੇ ਮਿਲਾ ਫਿਰ ਮੈਂ ਤੁਹਾਨੂੰ ਠੀਕ ਹੈ ਨਾਲ ਸਾਰਾ ਸਿਸਟਮ ਹੀ ਲੈ ਆਵਾਂ ਹਾਂ ਤਾਂ ਸਾਰਾ ਸਿਸਟਮ ਫਿਰ ਮੈਂ ਲੈਂਦਾ ਆਵਾਂ ਹੈ ਨਾ

ਵਧੀਆ ਤਾਂ ਹੋ ਜਾਏਗਾ ਹੈ ਨਾ ਹਾਂ ਚਲੋ ਫਿਰ ਮੈਂ ਸਰ ਦੂਜਾ ਜਦੋਂ ਵੀ ਮੈਨੂੰ ਟਾਈਮ ਲੱਗਦਾ ਨਾ ਤਾਂ ਮੈਂ ਤੁਆਡੀ ਸ਼ੋਪ 'ਤੇ ਪਹੁੰਚਦਾ ਅਤੇ ਮੈਂ ਤੁਹਾਡੇ ਬਾਰੇ ਕਾਫ਼ੀ ਸੁਣਿਆ ਵੀ ਤੁਸੀਂ ਚੰਗਾ ਵਧੀਆ ਤਸੱਲੀਬਖਸ਼ ਕੰਮ ਕਰਦੇ ਹੋ ਠੀਕ ਹੈ ਜੀ ਅਤੇ ਜੇ ਮਤਲਬ ਵਧੀਆ ਬਣ ਗਿਆ ਜੇ ਕੰਪਿਊਟਰ ਵਧੀਆ ਬਣ ਗਿਆ ਨਾ ਨਹੀਂ ਮੇਰਾ ਜੀ ਹਾਂਜੀ ਆਪਣਾ ਹੀ ਕੰਮ ਹੈ ਅਤੇ ਮੇਰਾ ਓਫਿਸ ਵੀ ਹੈਗਾ ਇੱਕ ਮੰਨ ਲਓ ਪ੍ਰਾਈਵੇਟ ਕੰਮ ਹੈ ਆਪਣਾ ਅਤੇ ਮੈਨੂੰ ਓੱਥੇ ਵੀ ਚਾਹੀਦਾ ਹੁੰਦਾ ਘਰ 'ਚ ਵੀ ਮੈਂ ਕਈ ਵਾਰੀ ਕਰਦਾ ਰਹਿੰਦਾ ਅਤੇ ਜੇ ਮੈਨੂੰ ਹਾਂ ਮੈਨੂੰ ਤੁਸੀਂ ਇੱਕ ਵਾਰੀ ਇੱਕ ਕਰਦੋ ਫਿਰ ਉਸ ਤੋਂ ਬਾਅਦ ਆਪਾਂ ਨੂੰ ਜਿੰਨੀ ਰਿਕੁਆਇਰਮੈਂਟ ਇੱਕ ਦੋ ਦੀ ਆਪਾਂ ਹੋਰ ਤਿਆਰ ਕਰਵਾਲਾਂਗੇ ਤੁਹਾਡੇ ਕੋਲੋਂ ਠੀਕ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਚਲੋ ਮੈਂ ਫਿਰ ਮਿਲਦਾ ਤੁਹਾਨੂੰ ਹਾਂਜੀ